ਹੈਲੋ ਸਤਿ ਸ਼੍ਰੀ ਅਕਾਲ ਸਰ ਮੀਸ਼ੋ ਤੋਂ ਗੱਲ ਕਰ ਰਹੇ ਹੈ ਜੀ ਹਾਂਜੀ ਮੈਂ ਗੁਰਦੀਪ ਸਿੰਘ ਜੀ ਪਿੰਡ ਮਾਨੂਪੁਰ ਜੀ ਹਾਂਜੀ ਮੈਂ ਨਾ ਦਸ ਦਿਨ ਪਹਿਲਾਂ ਜੀ ਆਪਣਾ ਨਾ ਘਰ ਵਾਸਤੇ ਡਿਨਰ ਸੈੱਟ ਮੰਗਵਾਇਆ ਸੀ ਦੀਵਾਲੀ ਵਾਸਤੇ ਜੀ ਅਤੇ ਉਹ ਨਾ ਵੀ ਮਤਲਬ ਪੈਕਿੰਗ ਉਹਦੀ ਬਾਹਰੋਂ ਬਹੁਤ ਖ਼ਰਾਬ ਸੀ ਜੀ ਅਤੇ ਵਿੱਚ ਪਲੇਟਾਂ ਵੀ ਟੁੱਟੀਆਂ ਸੀ ਜੀ ਅਤੇ ਮੈਂ ਬਹੁਤ ਨਾਰਾਜ਼ ਹੋਇਆ ਜੀ ਉਹਨੂੰ ਦੇਖ ਕੇ ਜੀ ਤੁਸੀਂ ਇਹਦਾ ਜਾਂ ਤਾਂ ਰਿਫੰਡ ਕਰ ਦਿਉ ਜਾਂ ਇਹਨੂੰ ਬਦਲ ਦਿਉ ਜੀ ਜਾਂ ਤਾਂ ਜੀ ਮੇਰੇ ਪੈਸੇ ਦਿੱਤੇ ਜਾਣ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਹੋਊਂਗਾ ਜੀ ਠੀਕ ਆ ਜੀ ਧੰਨਵਾਦ ਸਰ